ਹਾਂਜੀ ਹਾਂਜੀ ਉਹ ਮੈਂ ਨਾ ਅੜੀਸਰ ਦੇ ਬਾਰੇ ਤਾਂ ਕਾਫੀ ਸੁਣਿਆ ਵਿਆ ਹੈਗਾ ਕਾਫੀ ਲੋਕ ਹੈ ਨਾ ਵੀ ਕਾਫੀ ਫੇਮਸ ਹੈਗਾ ਬਰਨਾਲੇ ਦੇ ਵਿੱਚ ਦੇਖੋ ਦੂਰੋਂ ਦੂਰੋਂ ਲੋਕ ਆਉਂਦੇ ਨੇ ਅੜੀਸਰ ਸਾਹਿਬ ਅਤੇ ਹੋਰ ਆਪਣੇ ਇੱਥੇ ਮੈਨੂੰ ਇਤਿਹਾਸਿਕ ਗੁਰਦੁਆਰਾ ਸਾਹਿਬ ਕਿਹੜੇ ਕਿਹੜੇ ਮੈਨੂੰ ਪਲੀਜ਼ ਗਾਈਡ ਕਰੋ ਤੁਸੀਂ ਮੈਂ ਸਾਰੇ ਜਾਣਾ ਚਾਹੁੰਦਾ ਹੈਗਾ ਹਾਂਜੀ ਹਾਂਜੀ ਅੱਛਾ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਜੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਅੱਛਾ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਅੱਛਾ ਅੱਛਾ ਠੀਕ ਹੈ ਜੀ ਅੱਛਾ ਜੀ ਹਾਂਜੀ ਅੱਛਾ ਜੀ ਅੱਛਾ ਅੱਛਾ ਗੁਰੂ ਤੇਗ ਬਹਾਦਰ ਜੀ ਨੂੰ ਠੀਕ ਹੈ ਜੀ ਅੱਛਾ ਅਤੇ ਆਪਣਾ ਇਹਨਾਂ ਦਾ ਕਿੰਨਾ ਕੁ ਫ ਫਾਸਲਾ ਜੀ ਆਪਸ ਵਿੱਚ ਕਿਲੋਮੀਟਰ ਦੇ ਨੇੜੇ ਨੇੜੇ ਆ ਕਿ ਕਿਲੋਮੀਟਰ ਹੈਗਾ ਕਾਫੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਇਹ ਤਾਂ ਆਪਣੇ ਬਰਨਾਲਾ ਰੋਡ ਹੀ ਬਠਿੰਡਾ ਬਰਨਾਲਾ ਰੋਡ ਸ਼ਾਇਦ ਅੱਛਾ ਉਹਦੀ ਵੀ ਕਾਫੀ ਮਹੱਤਤਾ ਹੈਗੀ ਉਹਦਾ ਕੀ ਇਤਿਹਾਸ ਹੈਗਾ ਮੈਨੂੰ ਕਲੀਅਰ ਨਹੀਂ ਹਾਲੇ ਕੁਛ ਸੋਹੀਆਣਾ ਸਾਹਿਬ ਦੀ

ਹਾਂਜੀ ਹਾਂਜੀ

ਹਾਂਜੀ ਹਾਂਜੀ ਅੱਛਾ ਅੱਛਾ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਜੀ ਢਿੱਲਵਾਂ ਠੀਕ ਹੈ ਜੀ ਇੱਧਰ ਓਕੇ ਓਕੇ ਠੀਕ ਹੈ ਜੀ ਅੱਛਾ ਜੀ ਅੱਛਾ ਅੱਛਾ ਠੀਕ ਹੈ ਜੀ ਅੱਛਾ ਅੱਛਾ ਜੀ ਅੱਛਾ ਅੱਛਾ ਇੱਕ ਨਾ ਮੈਨੂੰ ਨਾ ਬ ਬਹੁਤ ਟਾਈਮ ਹੋ ਗਿਆ ਲੰਗਰ ਖਾਣ ਨੂੰ ਬਹੁਤ ਜੀਅ ਕਰਦਾ ਲੰਗਰ ਸਾਰੇ ਗੁਰਦੁਆਰਿਆਂ ਦੇ ਵਿੱਚ ਕਿਸੇ ਖਾਸ ਦਿਨ ਹੁੰਦਾ ਕਿ ਕਦੋਂ ਮਰਜ਼ੀ ਹੈਗਾ

ਅੱਛਾ ਜੀ ਹਾਂਜੀ ਹਾਂ ਨਹੀਂ ਬਹੁਤ ਇੱਛਾ ਹੁੰਦੀ ਹੈ ਜੀ ਬਾਹਲਾ ਟਾਈਮ ਹੋ ਗਿਆ ਨੇ ਬਾਹਰ ਗਏ ਹੋਏ ਐਗੇ ਅਤੇ ਚੱਲ ਵੀ ਐਂ ਪੰਜਾਬ ਦੇ ਆਪਣੇ ਗੁਰਦੁਆਰਿਆਂ ਦਾ ਥੋੜ੍ਹਾ ਜਿਹਾ ਹੈ ਨਾ ਆਪਣੇ ਮਾਣ ਸਤਿਕਾਰ ਥੋੜ੍ਹਾ ਜਿਹਾ ਵੱਧ ਹੁੰਦਾ ਆਪਣੇ ਦਿਲ ਦੇ ਵਿੱਚ ਬਸ ਹੁੰਦਾ ਹੀ ਹੈ ਲੰਗਰ ਛਕ ਕੇ ਆਈਏ ਹੈ ਨਾ ਅਤੇ ਤਾਂ ਹੀ ਮੈਂ ਹਾਂਜੀ ਹਾਂਜੀ ਹਾਂਜੀ ਹਾਂਜੀ ਨਹੀਂ ਵੱਡੀ ਗੱਡੀ ਹੈ ਮੈਂ ਬਾਈ ਜੀ ਤੁਹਾਨੂੰ ਨਾਲ ਜ਼ਰੂਰ ਲੈ ਕੇ ਜਾਊਂਗਾ ਕਿਉਂਕਿ ਸਾਨੂੰ ਹਾਲੇ ਘੱਟ ਪਤਾ ਹੈਗਾ ਰਾਹਾਂ ਦਾ ਅਤੇ ਰਿਕਐਸਟ ਹੀ ਹੈਗੀ ਦਰਸ਼ਨ ਸਾਨੂੰ ਜ਼ਰੂਰ ਕਰਵਾ ਦਿਉ ਤੁਸੀਂ ਇੱਕ ਵਾਰ ਹਾਂਜੀ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਓਕੇ